ਸਤਿ ਸ਼੍ਰੀ ਅਕਾਲ ਕੀ ਤੁਸੀਂ ਸਵਿੱਗੀ ਤੋਂ ਗੱਲ ਕਰ ਰਹੇ ਹੋ ਜੀ ਮੈਂ ਸੰਦੀਪ ਗੱਲ ਕਰ ਰਿਹਾ ਹਾਂ ਅਤੇ ਮੈਂ ਥੋੜ੍ਹੀ ਦੇਰ ਪਹਿਲਾਂ ਹੀ ਦਾਵਤ ਰੈਸਟੋਰੈਂਟ ਵਿੱਚ ਆਪਣਾ ਓਡਰ ਕੀਤਾ ਸੀ ਓਡਰ ਦੇ ਵਿੱਚ ਮਟਰ ਪਨੀਰ ਹਾਫ ਕੜਾਹੀ ਪਨੀਰ ਹਾਫ ਅਤੇ ਦੋ ਰਸਗੁੱਲੇ ਅਤੇ ਦਸ ਰੋਟੀਆਂ ਮਿੱਸੀਆਂ ਜੋ ਤੁਸੀਂ ਕੜਾਹੀ ਪਨੀਰ ਬਣਾਉਂਗੇ ਉਸਦੇ ਵਿੱਚ ਓਇਲ ਘੱਟ ਤੋਂ ਘੱਟ ਰੱਖਿਓ ਅਤੇ ਜੋ ਤੁਸੀਂ ਮਟਰ ਪਨੀਰ ਬਣਾਓਗੇ ਉਸਦੇ ਵਿੱਚ ਵੀ ਘੱਟ ਤੋਂ ਘੱਟ ਓਇਲ ਰੱਖਿਓ ਜੋ ਤੁਸੀਂ ਰਸਗੁੱਲੇ ਭੇਜੋਗੇ ਉਸਦੇ ਵਿੱਚ ਵੀ ਚਾਸ਼ਨੀ ਹੈ ਉਹ ਨਾ ਪਾਇਓ ਸੋ ਕਿਰਪਾ ਕਰਕੇ ਪਲੀਜ਼ ਮੇਰਾ ਓਡਰ ਹੈ ਜੋ ਜਲਦੀ ਭੇਜ ਦਿਓ ਥੈਂਕ ਊ ਸੋ ਮਚ